ਰੈਸਪੀ ਦੀ ਬਿਲਕੁਲ ਪਾਲਣਾ ਕਰਦੇ ਹਾਂ ਅਤੇ ਅਸ ਮੈਂ ਆਪਣੇ ਸਵਾਦ ਨਾਲ ਸਬਜ਼ੀ ਕੋਈ ਵੀ ਸਬਜ਼ੀ ਹੈ ਤਾਂ ਮੈਂ ਉਸਨੂੰ ਆਪਣੇ ਸਵਾਦ ਨਾਲ ਬਣਾਉਦੀ ਹਾਂ ਮੈਂ ਹੁਣ ਦੂਸਰੇ ਦੇ ਵਿੱ ਦੂਸਰੇ ਦੀ ਰੈਸਪੀ ਦੇ ਵਿੱਚ ਇਹ ਚੀਜ਼ ਦੇਖਦੀ ਹਾਂ ਕਿ ਇਹਨਾਂ ਨੇ ਕਿਹੜੇ ਕਿਹੜੇ ਇਨਗਰਿੰਟ ਪਾਏ ਹਨ ਜੇਕਰ ਉਹਨਾਂ ਵਿੱਚੋਂ ਮੈਨੂੰ ਕੋਈ ਅਲੱਗ ਲੱਗਦਾ ਹੈ ਤਾਂ ਮੈਂ ਉਸਦੇ ਅਕੋਡਿੰਗ ਮੈਂ ਆਪਣੀ ਸਬਜ਼ੀ ਦੇ ਵਿੱਚ ਖੁਦ ਦਾ ਅਲੱਗ ਤੋਂ ਫਲੇਵਰ ਪਾਉਂਦੀ ਹਾਂ ਹਰੇਕ ਦੇ ਸਵਾਦ ਦਾ ਫਰਕ ਹੁੰਦਾ ਹੈ ਅਤੇ ਮੈਂ ਬਿਲਕੁਲ ਮੈਨੂੰ ਕਿਸੇ ਦੇ ਵੀ ਹੱਥ ਦੀ ਸਬਜ਼ੀ ਦਾ ਟੇਸਟ ਉਵੇਂ ਦਾ ਨਹੀਂ ਆਉਂਦਾ ਜਿਵੇਂ ਦਾ ਮੈਂ ਖੁਦ ਬਣਵਾਉਂਦੀ ਹਾਂ ਇਸ ਕਰਕੇ ਜ਼ਿਆਦਾਤਰ ਮੈਂ ਆਪਣੇ ਹੱਥ ਦੀ ਸਬਜ਼ੀ ਬਣਾ ਕੇ ਖੁਸ਼ ਹੁੰਦੀ ਹਾਂ ਜਿਸ ਨਾਲ ਕਿ ਖਾਣ ਵਾਲੇ ਦੇ ਮਨ ਨੂੰ ਵੀ ਖੁਸ਼ੀ ਲੱਗੇ ਮੈਂ ਬਹੁਤ ਹੀ ਪਿਆਰ ਅਤੇ ਪਿਆਰ ਨਾਲ ਬਣਾਉਂਦੀ ਹਾਂ ਤਾਂ ਜੋ ਉਸਦੇ ਵਿੱਚ ਪਿਆਰ ਖੂਸ਼ਬੂ ਅਤੇ ਸਾਰਾ ਜੋ ਹੈ ਮਸਾਲੇ ਵਗੈਰਾ ਪਾ ਕੇ ਉਹਨਾਂ ਨੂੰ ਬਣਾ ਸਕਾਂ ਜਦੋਂ ਮੈਂ ਮਸਾਲੇ ਬਣਾਉਂਦੀ ਹਾਂ ਸਬਜ਼ੀ ਤਿਆਰ ਕਰਦੀ ਹਾਂ ਤਾਂ ਉਹਦੇ ਵਿੱਚ ਮੈਂ ਆਪਣੇ ਕੁਝ ਦੇਸੀ ਮਸਾਲੇ ਵੀ ਪਾਉਂਦੀ ਹਾਂ ਜਿਸ ਨਾਲ ਸਬਜ਼ੀ ਦਾ ਟੇਸਟ ਰੈਸਪੀ ਦਾ ਅਲੱਗ ਹੋ ਜਾਂਦਾ ਹੈ ਜੋ ਕਿ ਨੋਰਮਲ ਸਬਜ਼ੀਆਂ ਨਾਲੋਂ ਡਿਫਰੈਂਟ ਹੁੰਦਾ ਹੈ ਜਦੋਂ ਆਪਾਂ ਕੋਈ ਵੀ ਮਸਾਲਾ ਆਪਣੇ ਘਰ ਦਾ ਤਿਆਰ ਕੀਤਾ ਉਸ ਸਬਜ਼ੀ ਵਿੱਚ ਪਾਉਂਦੇ ਹਾਂ ਤਾਂ ਉਹ ਸਬਜ਼ੀ ਅਤੇ ਬਾਹਰਲੀ ਸਬਜ਼ੀ ਦਾ ਟੇਸਟ ਬਹੁਤ ਅਲੱਗ ਹੁੰਦਾ ਚਾਹੇ ਉਹ ਸਬਜ਼ੀ ਕੋਈ ਵੀ ਸੇਮ ਹੁੰਦੀ ਆ ਪਰ ਉਸਦੇ ਰੈਸਪੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਆ ਮੈਂ ਜਹ ਮੈਂ ਆਪਣੀ ਸਬਜ਼ੀ ਦੇ ਵਿੱਚ ਜ਼ਿਆਦਾ ਇਹ ਸੁਧਾਰ ਕਰਦੀ ਹਾਂ ਕਿ ਮੈਂ ਬਾਹਰਲੀਆਂ ਚੀਜ਼ਾਂ ਘੱਟ ਵਰਤਦੇ ਹੋਏ ਘਰ ਦੀਆਂ ਚੀਜ਼ਾਂ ਅਤੇ ਜ਼ਿਆਦਾ ਮੈਂ ਉਹ ਚੀਜ਼ਾਂ ਵਰਤਣ ਜੋ ਕਿ ਸਾਡੇ ਘਰ ਦੇ ਵਿੱਚ ਤਿਆਰ ਕੀਤੀਆਂ ਗਈਆਂ ਹਨ ਜਦੋਂ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਹਨ ਤਾਂ ਉਹਨਾਂ ਸਬਜ਼ੀਆਂ ਨੂੰ ਮੈਂ ਉਸ ਦੇ ਅਕੋਡਿੰਗ ਆਪਣੀ ਤਿਆਰ ਕੀਤੇ ਹੋਏ ਮਸਾਲੇ ਰਾਹੀਂ ਤਿਆਰ ਕਰਦੀ ਹਾਂ ਜੋ ਕਿ ਉਹਨਾਂ ਦੇ ਫਲੇਵਰ ਟੇਸਟ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਸਬਜ਼ੀ ਬਾਹਰੋਂ ਨਹੀਂ ਘਰ ਤਿਆਰ ਕੀਤੀ ਗਈ ਸਬਜ਼ੀ ਹੈ ਜਦੋਂ ਅਸੀਂ ਸਬਜ਼ੀ ਆਪਾਂ ਤਿਆਰ ਕਰਦੇ ਹਾਂ ਤਾਂ ਉਸਦੇ ਵਿੱਚ ਆਪਣਾ ਪਿਆਰ ਆਪਣੇ ਹੱਥਾਂ ਦਾ ਟੇਸਟ ਉਸ ਸਬਜ਼ੀ ਦੇ ਵਿੱਚ ਨਿਖਰ ਕੇ ਆਉਂਦਾ ਹੈ ਜੋ ਕਿ ਆਪਾਂ ਨੇ ਤਿਆਰ ਕੀਤੀ ਹੋਈ ਹੁੰਦੀ ਹੈ ਅਤੇ ਖਾਣ ਵਾਲੇ ਨੂੰ ਵੀ ਉਸ ਸਬਜ਼ੀ ਉੱਤੇ ਬਹੁਤ ਜ਼ਿਆਦਾ ਟੇਸ ਸਵਾਦ ਆਉਂਦਾ ਹੈ ਕਿਉਂਕਿ ਕਿਸੇ ਦੀ ਮਿਹਨਤ 'ਤੇ ਕੀਤੇ ਹੋਏ ਦਾ ਸਵਾਦ ਕਿਸੇ ਨੂੰ ਅਲੱਗ ਤੋਂ ਹੀ ਆਉਂਦਾ ਹੈ ਜਦੋਂ ਆਪਾਂ ਬਾਹਰਲੀਆਂ ਸਬਜ਼ੀਆਂ ਖਾਂਦੇ ਹਾਂ ਤਾਂ ਆਪਾਂ ਨੂੰ ਉੱਨਾ ਵਧੀਆ ਸਵਾਦ ਨਹੀਂ ਆਉਂਦਾ ਜਿੰਨਾ ਕਿ ਆਪਾਂ ਚਾਹੁੰਦੇ ਹਾਂ ਪਰ ਮੈਂ ਹਰੇਕ ਸਬਜ਼ੀ ਦੇ ਵਿੱਚ ਬਹੁਤ ਹੀ ਲਗਨ ਨਾਲ ਟੇਸਟ ਦਾ ਜ਼ਾਇਕਾ ਲਾਉਂਦੀ ਹਾਂ ਤਾਂ ਜੋ ਮੇਰੀ ਸਬਜ਼ੀ ਖਾਣ ਵਾਲੇ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਤਾਂ ਜੋ ਉਹ ਪਹਿਲੀ ਵਾਰ ਖਾ ਕੇ ਵਾਰ ਵਾਰ ਮੇਰੇ ਕੋਲ ਸਬਜ਼ੀ ਖਾਣ ਲਈ ਆਵੇ ਇਹ ਨਹੀਂ ਕੀ ਸਬਜ਼ੀ ਉਹ ਕੱਲੀ ਖਾਣੀ ਹੈ ਜ਼ਰੂਰੀ ਨਹੀਂ ਹੁੰਦਾ ਕੋਈ ਵੀ ਮੈਂ ਰੈ ਕੋਈ ਵੀ ਰੈਸਪੀ ਆ ਤਾਂ ਮੈਂ ਉਹਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਵਟ ਨਾਲ ਬਣਾਉਂਦੀ ਹਾਂ ਕਿ ਖਾਣ ਵਾਲੇ ਅਤੇ ਦੇਖਣ ਵਾਲੇ ਦਾ ਇਹ ਹੋਵੇ ਕਿ ਡੈਕੋਰੇਸ਼ਨ ਖਾਣ ਵਾਲੇ ਦਾ ਟੇਸਟ ਕਿਵੇਂ ਦਾ ਵਧੀਆ ਲੱਗਦਾ ਹੈ ਜਦੋਂ ਅਸੀਂ ਐਵੇਂ ਕਰਦੇ ਹਾਂ ਤਾਂ ਖਾਣ ਵਾਲੇ ਦਾ ਨਾ ਵੀ ਮਨ ਹੋਵੇ ਤਾਂ ਵੀ ਉਹ ਇੱਕ ਜਾਂ ਅੱਧੀ ਰੋਟੀ ਖਾ ਕੇ ਜਾਂਦਾ ਹੈ ਕਿ ਉਸਨੂੰ ਉਸ ਸਬਜ਼ੀ ਦੀ ਫ੍ਰੈਗਰੈਂਸ ਹੀ ਇੰਨੀ ਆਉਂਦੀ ਹੈ ਕਿ ਉਸਦਾ ਦਿਲ ਨਾ ਖਾਣਾ ਕਰਕੇ ਖਾਣ ਲਈ ਕਰ ਜਾਂਦਾ ਹੈ ਜੋ ਕਿ ਉਹਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਅਤੇ ਉਹ ਫਿਰ ਮਨ ਚਾਹ ਕੇ ਅਗਲਾ ਆਪਣਾ ਪੂਰੀ ਢਿੱਡ ਭਰ ਕੇ ਰੋਟੀ ਪਾਣੀ ਖਾਂਦਾ ਹੈ